ਮੈਂ ਸ਼ੀਤਲ ਕੁਮਾਰੀ ਮਿਰਜ਼ਾਪੁਰ ਦੀ ਰਹਿਣ ਵਾਲੀ ਹਾਂ ਜੋ ਕਿ ਪਠਾਨਕੋਟ ਜ਼ਿਲ੍ਹੇ ਵਿੱਚ ਪੈਂਦਾ ਹੈ ਮੈਂ ਦੱਸ ਰਹੀ ਹਾਂ ਕਿ ਸਾਡੇ ਇਲਾਕੇ ਵਿੱਚ ਸਿਹਤ ਸਹੂਲਤਾਂ ਜਿਵੇਂ ਕਿ ਸਭ ਤੋਂ ਵੱਧ ਅਸੀਂ ਗੱਲ ਕਰੀਏ ਤਾਂ ਸਿਹਤ ਸਮੱਸਿਆਵਾਂ ਦੀ ਤਾਂ ਦੱਸਿਆ ਜਾ ਸਕਦਾ ਹੈ ਕਿ ਸਿਹਤ ਸਹੂਲਤਾਂ ਵਿੱਚ ਕੁਝ ਲੋਕਾਂ ਨੂੰ ਆਮ ਦੇਖਣ ਵਿੱਚ ਆਇਆ ਹੈ ਕਿ ਛੂਤ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਭਾਵ ਕਿ ਜੋ ਇੱਕ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਨਹੀਂ ਰੱਖਦੇ ਜਾਂ ਗੰਦਗੀ ਵਿੱਚ ਰਹਿੰਦੇ ਹਨ ਉਹਨਾਂ ਨੂੰ ਇਹ ਰੋਗ ਲੱਗ ਜਾਂਦੇ ਹਨ ਇਸ ਕਰਕੇ ਕਿਹਾ ਜਾਂਦਾ ਹੈ ਕਿ ਆਪਣੇ ਸਰੀਰ ਨੂੰ ਸਾਫ ਸੁਥਰਾ ਰੱਖੋ ਤਾਂ ਕਿ ਇਹ ਬਿਮਾਰੀਆਂ ਨਾ ਲੱਗਣ ਅਸੀਂ ਕਈ ਤਰ੍ਹਾਂ ਦੀਆਂ ਗੈਰ ਛਚਾਈਆ ਬਿਮਾਰੀਆਂ ਦੀ ਗੱਲ ਕਰ ਸਕਦੇ ਹਾਂ ਜਿਸ ਤਰ੍ਹਾਂ ਕਈ ਬੱਚੇ ਕਪੋਸ਼ਣ ਦੇ ਸ਼ਿਕਾਰ ਹੁੰਦੇ ਹਨ ਭਾਵ ਕਿ ਉਹਨਾਂ ਦੀ ਸਿਹਤ ਨਹੀਂ ਬਣਦੀ ਉਹ ਕਮਜ਼ੋਰ ਹੋ ਜਾਂਦੇ ਹਨ ਉਹ ਪਤਲੇ ਦੁਗਲੇ ਭਾਵ ਕਿ ਉਹ ਜਦੋਂ ਕੁਝ ਖਾਂਦੇ ਪੀਂਦੇ ਹਨ ਤਾਂ ਉਹਨਾਂ ਨੂੰ ਲੱਗਦਾ ਨਹੀਂ ਹੈ ਅਤੇ ਉਹ ਸਦਾ ਕਮਜ਼ੋਰ ਹੁੰਦੇ ਚਲੇ ਜਾਂਦੇ ਹਨ ਇਸ ਕਰਕੇ ਸਾਨੂੰ ਇਹਨਾਂ ਕਾਰਨਾਂ ਕਰਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਸਮੇਂ ਦੇ ਅਨੁਸਾਰ ਡਾਕਟਰੀ ਦੀ ਦਵਾਈ ਲੈ ਕੇ ਉਸ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ ਜੇਕਰ ਅਸੀਂ ਇਹ ਚੀਜ਼ਾਂ ਦਾ ਸੇਵਨ ਕਰੀਏ ਕਿ ਸਮੇਂ ਦੀ ਲਿਹਾਜ ਨਾਲ ਫਲ ਫਰੂਟ ਸਬਜ਼ੀਆਂ ਦਾਲਾਂ ਆਦਿ ਖਾਈਏ ਤਾਂ ਕਦੀ ਵੀ ਬੱਚੇ ਪੋਸ਼ਕ ਦਾ ਸ਼ਿਕਾਰ ਨਹੀਂ ਹੋਣਗੇ ਇਹਨਾਂ ਸਮੱਸਿਆਵਾਂ ਦੀ ਦੇਖ ਰੇਖ ਲਈ ਸਾਨੂੰ ਨੇੜੇ ਨੇੜਲੇ ਸਿਹਤ ਕੇਂਦਰਾਂ ਵਿੱਚ ਜਾ ਕੇ ਚੰਗੇ ਸਲਾਹਕਾਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਤਾਂ ਹੀ ਸਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ ਧੰਨਵਾਦ ਜੀ